ਹਾਂਜੀ ਨਮਸਕਾਰ ਜੀ ਹਾਂਜੀ ਸਰ ਹਾਂਜੀ ਓਕੇ ਬੋਲ ਰਿਹਾ ਜੀ ਤੁਸੀਂ ਕੋਣ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਭਾਅ ਜੀ ਦੇਖੋ ਜੀ ਵੈਸੇ ਮੈਂ ਸਟੇਸ਼ਨ ਮਾਸਟਰ ਬੋਲ ਰਿਹਾ ਜੀ ਵੈਸੇ ਤਾਂ ਆਨਲਾਈਨ ਹੀ ਪਤਾ ਲੱਗ ਜਾਂਦਾ ਅੱਜ ਕੱਲ੍ਹ ਅਤੇ ਪਰ ਕੋਈ ਨਹੀਂ ਤੁਸੀਂ ਫੋਨ ਮਿਲਾਇਆ ਤਾਂ ਆਪਾਂ ਤੁਹਾਨੂੰ ਦੱਸਾਂਗੇ ਤੁਸੀਂ ਜਾਣਾ ਕਿੱਥੇ ਆ ਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਜੀ ਅੱਛਾ ਜੀ ਓ ਅੱਛਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਦੇਖੋ ਜੀ ਇੱਕ ਤਾਂ ਐਵੇਂ ਆ ਕਿ ਜੀ ਫਾਜ਼ਿਲਕਾ ਦੋ ਮੇਨ ਲਾਈਨਾਂ ਨਾਲ ਜੁੜਿਆ ਹੋਇਆ ਜੀ ਇੱਕ ਤਾਂ ਜੀ ਗੰਗਾ ਜੀ ਫਿਰੋਜਪੁਰ ਜੀ ਆਪਣਾ ਠੀਕ ਹੈ ਜੀ ਇੱਕ ਆਪਣਾ ਬਠਿੰੰਡਾ ਵਾਇਆ ਮੁਕਤਸਰ ਹੋ ਕੇ ਅਤੇ ਇਸ ਰੂਟ 'ਤੇ ਜੀ ਗੱਡੀਆਂ ਚਲਦੀਆਂ ਤੁਸੀਂ ਜਿੰਨੇ ਵੀ ਸਟੇਸ਼ਨ ਬੋਲੇ ਆ ਨਾ ਲਗਭਗ ਸਾਰੇ ਪਾਸੇ ਫਾਜ਼ਿਲਕਾ ਟਰੇਨ ਜਾਂਦੀ ਹੈ ਜੀ ਤੁਸੀਂ ਆਪਣੇ ਸਹੁਰਾ ਪਰਿਵਾਰ ਦੀ ਗੱਲ ਕਰੋ ਤਾਂ ਤੁਸੀਂ ਗੰਗਾ ਨਗਰ ਕਹਿ ਰਹੇ ਸੀ ਗੰਗਾ ਨਗਰ ਦੀ ਟ੍ਰੇਨ ਜਾਂਦੀ ਆ ਜੀ ਬਿਲਕੁਲ ਡਰੈਕਟ ਲਾਈਨ ਆ ਜੀ ਫਾਜਿਲਕਾ ਤੋਂ ਅਬੋਹਰ ਅਬੋਹਰ ਤੋਂ ਗੰਗਾ ਨਗਰ ਸਵੇਰੇ ਟ੍ਰੇਨ ਜਾਂਦੀ ਆ ਸਵੇਰੇ ਸੱਤ ਵਜੇ ਗੰਗਾ ਨਗਰ ਜਾਊਗੀ ਸਿੱਧੀ ਇੰਟਰਸੀਟੀ ਟਰੇਨ ਹੈ ਜੀ ਐਕਸਪ੍ਰੈਸ ਜੇ ਤੁਸੀਂ ਅੰਮ੍ਰਿਤਸਰ ਦੀ ਗੱਲ ਕਰੋ ਤਾਂ ਮੈਂ ਹਾਂ ਜਨਰਲ ਡੱਬੇ ਵੀ ਹੈ ਤੁਸੀਂ ਜੇਕਰ ਬੁਕਿੰਗ ਕਰਵਾਉਣੀ ਏ ਤਾਂ ਬੁਕਿੰਗ ਕਰਾ ਸਕਦੇ ਜਨਰਲ ਡੱਬੇ ਹੈਗੇ ਵੈਸੇ ਕਿਉਂਕਿ ਛੋਟੇ ਰੂਟ ਦੀ ਟ੍ਰੇਨ ਆ ਉਹ ਅਤੇ ਜੇਕਰ ਅੰਮ੍ਰਿਤਸਰ ਦੀ ਤੁਸੀਂ ਗੱਲ ਕੀਤੀ ਸੀ ਤਾਂ ਜੀ ਉਹਦੇ 'ਚ ਐਵੇਂ ਆ ਜੀ ਰੋਜ਼ ਟ੍ਰੇਨ ਨਹੀਂ ਹਫ਼ਤੇ 'ਚ ਇੱਕ ਵਾਰ ਚੱਲਦੀ ਡੇਲੀ ਸਪੈਸ਼ਲ ਹੈ ਜੀ ਉਹ ਡੇਲੀ ਸਪੈਸ਼ਲ ਨਹੀਂ ਸੌਰੀ ਵੀਕਲੀ ਸਪੈਸ਼ਲ ਹੈ ਜੀ ਉਹ ਚੱਲਦੀ ਬੀਕਾਨੇਰ ਤੋਂ ਅੰਮ੍ਰਿਤਸਰ ਵੀਰਵਾਰ ਸ਼ੁੱਕਰਵਾਰ ਚਲਦੀ ਹੈ ਜੀ ਨਹੀਂ ਨਹੀਂ ਇੱਕ ਦਿਨ ਹੈ ਜੀ ਬਸ ਇੱਕ ਦਿਨ ਜਾਂਦੀ ਇੱਕ ਦਿਨ ਆਉਂਦੀ ਹੈ ਜੀ ਹਾਲੇ ਤੱਕ ਤਾਂ ਵੀ ਇਹੀ ਹੈ ਜੀ ਅੱਗੇ ਚੱਲ ਕੇ ਹੋ ਜੇ ਤਾਂ ਕੁਝ ਕਹਿ ਨਹੀਂ ਸਕਦੇ ਇੱਕ ਤੁਸੀਂ ਗੱਲ ਕੀਤੀ ਸੀ ਅੰਬਾਲਾ ਦੀ ਅੰਬਾਲਾ ਬਿਲਕੁਲ ਸਿੱਧੀ ਡਰੈਕਟ ਟਰੇਨ ਹੈ ਜੀ ਫਾਜਿਲਕਾ ਤੋਂ ਰਾਤ ਨੂੰ ਦੋ ਵਜੇ ਚੱਲੂਗੀ ਜੀ ਇੰਟਰਸੀਟੀ ਐਕਸਪ੍ਰੈਸ ਹੈ ਦਿੱਲੀ ਜਾਊਗੀ ਸਿੱਧੀ ਅੰਬਾਲਾ ਹੋ ਕੇ ਜਾਊਗੀ ਤੁਹਾਨੂੰ ਸਵੇਰੇ ਅੰਬਾਲਾ ਲਾਹ ਦਊਗੀ ਦਸ ਕੁ ਵਜੇ ਤੱਕ ਨੌਂ ਦਸ ਵਜੇ ਤੱਕ ਖਾਟੂ ਸ਼ਾਮ ਵੀ ਤੁਸੀਂ ਜਾਣਾ ਤਾਂ ਗੰਗਾ ਨਗਰ ਹੋ ਕੇ ਜਾਓ ਜੀ ਵਾਇਆ ਵਧੀਆ ਖਾਟੂ ਸ਼ਾਮ ਨੂੰ ਜਾਓ ਉਹ ਸਾਰਾ ਗੰਗਾ ਨਗਰ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਜਿਵੇਂ ਤੁਸੀਂ ਜਾਣਾ ਚਾਹੁੰਦੇ ਹੋ ਇਹ ਤੁਹਾਨੂੰ ਦਿੱਕਤ ਨਹੀਂ ਆਏ ਹੁਣ ਫਾਜਿਲਕਾ ਵਧੀਆ ਹੋ ਗਿਆ ਸਟੇਸ਼ਨ ਰਾਜਧਾਨੀ ਦਾ ਜੀ ਹੁਣ ਕੀ ਕਹੀਏ ਜੀ ਹੁਣ ਤੁਹਾਨੂੰ ਰਾਜਧਾਨੀ ਤਾਂ ਹਜੇ ਤੱਕ ਨਹੀਂ ਚਲੀਆ ਰਾਜਧਾਨੀ ਛੱਡੋ ਜੀ ਇੰਟਰਸੀਟੀਆਂ ਚਲਾ ਦੇਣ ਵਧੀਆ ਜੀ ਤੁਹਾਨੂੰ ਤਾਂ ਉਹੀ ਬੜਾ ਵਧੀਆ ਹੋ ਜਾਏਗਾ ਸਾਨੂੰ ਤਾਂ ਚਲੋ ਹੋਣਾ ਹੀ ਹੋਣਾ ਰਾਜਧਾਨੀ ਤਾਂ ਜੀ ਨਹੀਂ ਹੈਗੀ ਰਾਜਧਾਨੀ ਤਾਂ ਮੈਂ ਕਹਿੰਦਾ ਨੇੜੇ ਤੇੜੇ ਵੀ ਨਹੀਂ ਹੈ ਫਾਜਿਲਕਾ ਦੇ ਨੇੜੇ ਤੇੜੇ ਵੀ ਨਹੀਂ ਹੈ ਹਾਂ ਉਹ ਤਾਂ ਹੈ ਜੀ ਉਹ ਤਾਂ ਉਹ ਤਾਂ ਘਰ ਵਰਗੀ ਗੱਲ ਹੈ ਜੀ ਅੱਛਾ ਜੀ ਹਾਂ ਹਾਂ ਏ ਸੀ ਹੈ ਇਹਨਾਂ 'ਚ ਜਿਹੜੀ ਅੰਬਾਲਾ ਵਾਲੀ ਟਰੇਨ ਆ ਜਿਹੜੀ ਦਿੱਲੀ ਜਾਊਗੀ ਏ ਸੀ ਏ ਸੀ ਬੁੱਕ ਕਰਾ ਸਕਦੇ ਹੋ ਹਾਂਜੀ ਹਾਂਜੀ ਪੱਕਾ ਸੌ ਪਰਸੈਂਟ ਹੈ ਜੀ ਹਾਂ ਨਹੀਂ ਗੱਲ ਤੁਹਾਡੀ ਮੈਂ ਸਹੀ ਸਮਝ ਗਿਆ ਨਾ ਅੰਬਾਲਾ ਵਾਲੀ 'ਚ ਵੀ ਏ ਸੀ ਹੈ ਹਾਂਜੀ ਹਾਂਜੀ ਅੰਬਾਲਾ ਵਾਲੀ 'ਚ ਵੀ ਏ ਸੀ ਹੈ ਜੀ ਅੰਮ੍ਰਿਤਸਰ ਵਾਲੀ 'ਚ ਵੀ ਏ ਸੀ ਹੈ ਜਿਹੜੀ ਸਵੇਰੇ ਗੰਗਾ ਨਗਰ ਜਾਊਗੀ ਉਹਦੇ 'ਚ ਏ ਸੀ ਨਹੀਂ ਹੈਗਾ ਅਤੇ ਤੁਹਾਨੂੰ ਲੋੜ ਵੀ ਨਹੀਂ ਉਹਦੇ 'ਚ ਕਿਉਂਕਿ ਤੁਸੀਂ ਦੋ ਘੰਟੇ ਸਵੇਰੇ ਸਵੇਰ ਠੰਢੇ ਠੰਢੇ ਜਾਓਗੇ ਠੰਢੇ ਠੰਢੇ ਪਹੁੰਚ ਜਾਓਗੇ ਨਾ ਨਾ ਜੀ ਜਮ੍ਹਾ ਦਿਕੱਤ ਨਹੀਂ ਹੈ ਸ਼ਾਂਤ ਏਰੀਆ ਹੈ ਜੀ ਬੜੇ ਵਧੀਆ ਮੈਨੂੰ ਆਪ ਨੂੰ ਬੜੇ ਵਧੀਆ ਲੱਗਿਆ ਜੀ ਮੈਂ ਤਾਂ ਮੈਂ ਤਾਂ ਹੁਸ਼ਿਆਰਪੁਰ ਦਾ ਨਹੀਂ ਮੈਂ ਫਾਜਿਕਲਾ ਜੋਬ ਕਰਦਾ ਮੈਨੂੰ ਤਾਂ ਬੜਾ ਵਧੀਆ ਲੱਗਿਆ ਏਰੀਆ ਜੀ ਸ਼ਾਤ ਏਰੀਆ ਆ ਜੀ ਸ਼ਾਂਤ ਸੁਭਾਅ ਵਾਲੇ ਲੋਕ ਹੈ ਜੀ ਕੋਈ ਟੈਂਸ਼ਨ ਦੀ ਗੱਲ ਹੀ ਨਹੀਂ ਹੈ ਹਾਂ ਹਾਂ ਜੀ ਆਰਾਮ ਨਾਲ ਆਰਾਮ ਨਾਲ ਕੋਈ ਕੋਈ ਕੋਈ ਨਹੀਂ ਜੀ ਆਰਾਮ ਨਾਲ ਕਰੋ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ